ਮੇਰਾ ਨਾਮ ਪਾਰਥ ਹੈ ਮੈਂ ਇੱਕ ਐਕਸ ਵਾਈ ਜੈੱਡ ਕੰਪਨੀ ਤੋਂ ਡਾਇਨਿੰਗ ਟੇਬਲ ਪਰਚੇਜ ਕੀਤਾ ਸੀ ਮੈਂ ਉਸ ਕੰਪਨੀ ਦੀ ਵੈੱਬਸਾਈਟ ਤੋਂ ਚੈੱਕ ਕੀਤਾ ਸੀ ਕਿ ਮੈਨੂੰ ਉਸ ਡਾਇਨਿੰਗ ਟੇਬਲ ਬਹੁਤ ਸੋਹਣਾ ਲੱਗਿਆ ਮੈਂ ਉਸਦੀ ਤਸਵੀਰ ਦੇਖੀ ਤਾਂ ਉਸਦਾ ਸ਼ੀਸ਼ਾ ਉਸਦਾ ਆਦਿ ਮਟੀਰੀਅਲ ਵਗੈਰਾ ਬਹੁਤ ਸੋਹਣਾ ਅਤੇ ਬਹੁਤ ਆਕਰਸ਼ਿਤ ਸੀ ਮੈਨੂੰ ਉਹ ਬਹੁਤ ਪਸੰਦ ਆਇਆ ਅਤੇ ਉਸਦਾ ਮ ਕਹਿੰਦੇ ਦਾਮ ਵੀ ਬਹੁਤ ਘੱਟ ਸੀ ਫੇਰ ਮੈਂ ਉਸ ਕੰਪਨੀ ਨਾਲ ਕੋਂਟੈਕਟ ਕੀਤਾ ਅਤੇ ਫਿਰ ਮੈਂ ਉਸ ਡਾਇਨਿੰਗ ਟੇਬਲ ਨੂੰ ਬੁੱਕ ਕਰ ਛੱਡਿਆ ਫਿਰ ਉਸਨੂੰ ਮੈਂ ਸੀ ਓ ਡੀ ਕੀਤਾ ਮੈਂ ਆਪਣੇ ਘਰ ਮੰਗਵਾਇਆ ਜਦ ਮੇਰੇ ਘਰ ਪਹੁੰਚਿਆ ਉਹ ਡਾਇਨਿੰਗ ਟੇਬਲ ਫਿਰ ਮੈਂ ਉਸਨੂੰ ਚੈੱਕ ਕੀਤਾ ਪਰ ਜੋ ਚੀਜ਼ ਉਸ ਵੈੱਬਸਾਈਟ 'ਤੇ ਦੱਸੀ ਗਈ ਸੀ ਉਹ ਚੀਜ਼ ਰੀਅਲ ਲਾਈਫ ਵਿੱਚ ਨਹੀਂ ਸੀ ਫਿਰ ਮੈਂ ਉਸ ਕੰਪਨੀ ਨਾਲ ਕਾਲ ਕਰਕੇ ਸਾਂਝਾ ਕੀਤਾ ਆਪਣਾ ਆਪਣਾ ਵਰਤਾਉ ਸਾਂਝਾ ਕੀਤਾ ਉਹਨਾਂ ਨੇ ਕਿਹਾ ਜੋ ਤੁਸੀਂ ਆਪਣਾ ਜੋ ਚੀਜ਼ ਔਡਰ ਕੀਤੀ ਸੀ ਇਹ ਉਹ ਚੀਜ਼ ਉਹੀ ਹੈ ਫਿਰ ਮੈਨੂੰ ਦੇਖਿਆ ਜੇ ਚੀਜ਼ ਬਿਲਕੁਲ ਹਲਕੀ ਕੰਪਨੀ ਦੀ ਸੀ ਫਿਰ ਮੈਂ ਉਸਨੂੰ ਰੀਸੇਲ ਕਰਨ ਵਾਸਤੇ ਸੋਚਿਆ ਬਹੁਤ ਸੋਚਿਆ ਆਪਣੇ ਘਰ ਡਿਸਕਸ ਵਗੈਰਾ ਕੀਤਾ ਫਿਰ ਸੋਚਿਆ ਇਹ ਰਿਟਰਨ ਕਰਾ ਦੇਵਾਂ ਪਰ ਜਦ ਉਸ ਕੰਪਨੀ ਨਾਲ ਮੈਂ ਗੱਲ ਕੀਤੀ ਪਰ ਉਸ ਕੰਪਨੀ ਕਹਿੰਦੇ ਆ ਜਿਹੜੀ ਆਪਣੇ ਚੀਜ਼ ਪਰਚੇਜ ਕੀਤੀ ਹੈ ਸੀ ਓ ਡੀ ਤਾਂ ਹੋ ਗਈ ਹੈ ਪਰ ਉਹ ਰਿਟਰਨ ਨਹੀਂ ਹੋ ਸਕਦੀ ਇਸ ਕਰਕੇ ਮੈਂ ਇਹ ਚਾਹੁੰਦਾ ਦੱਸਣਾ ਚਾਹੁੰਦਾ ਹਾਂ ਕਿ ਕਦੀ ਵੀ ਜਿਹੜੀ ਔਨਲਾਈਨ ਚੀਜ਼ ਦੇਖਦੇ ਹਾਂ ਉਸ 'ਤੇ ਪਹਿਲੇ ਟਰੱਸਟ ਨਹੀਂ ਕਰਨਾ ਚਾਹੀਦਾ